ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਪਹਿਲਾਂ ਤਾਂ ਐਂ ਦੱਸੋ ਜੀ ਵਿਦ ਫੈਮਲੀ ਆਏ ਹੋ ਵਿਦ ਫੈਮਲੀ ਕਾਰ 'ਤੇ ਆਉਂਗੇ ਜੀ ਹਾਂਜੀ ਠੀਕ ਹੈ ਜੀ ਤੁਸੀਂ ਦੇਖੋ ਦੋ ਦਿਨ ਲੱਗ ਜਾਣਗੇ ਤੁਹਾਨੂੰ ਸਾਰੇ ਬਠਿੰਡੇ ਬਠਿੰਡੇ 'ਚ ਹੀ ਜਿਵੇਂ ਇੱਥੇ ਇੱਕ ਜੇ ਇਤਿਹਾਸਿਕ ਥਾਂ ਪੁੱਛੀ ਸੀ ਉਹ ਤਾਂ ਹੈਗੀ ਕਿਲ੍ਹਾ ਮੁਬਾਰਕ ਠੀਕ ਹੈ ਉਹ ਸਾਰੀਆਂ ਜਿਹੜੀਆਂ ਸਪੇਸਿਸ ਹੈ ਜਾਂ ਤਾਂ ਆਪਾਂ ਗੂਗਲ ਕਰ ਲਾਂਗੇ ਜਾਂ ਤੁਸੀਂ ਮੈਨੂੰ ਨਾਲ ਚੱਕ ਲਿਓ ਠੀਕ ਹੈ ਜੀ ਤੁਹਾਨੂੰ ਮੈਂ ਲੈ ਚੱਲੂੰਗਾ ਨਾਲੇ ਉੱਥੋਂ ਦੀ ਜਿਹੜੀ ਹਿਸਟਰੀ ਉਹ ਵੀ ਦੱਸ ਦੂੰਗਾ ਇੱਕ ਤਾਂ ਹੈਗੀ ਹੈ ਜੀ ਕਿਲ੍ਹਾ ਮੁਬਾਰਕ ਹੈਗੀ ਜਿਹੜੀ ਇਤਿਹਾਸਿਕ ਥਾਂ ਹੈ ਠੀਕ ਹੈ ਜੀ ਦੂਸਰਾ ਆਪਾਂ ਜਾ ਸਕਦੇ ਹਾਂ ਜਿਵੇਂ ਇੱਥੇ ਆਊਟਿੰਗ ਕਰਨ ਵਾਸਤੇ ਹੈਗੇ ਆ ਮੋਲ ਹੈਗੇ ਆ ਹੈ ਨਾ ਕੋਈ ਆਊਟਲਟਸ 'ਚ ਜਾ ਸਕਦੇ ਹਾਂ ਕੋਈ ਝੀਲਾਂ ਨੇ ਉੱਥੇ ਵੋਟਿੰਗ ਕਰ ਸਕਦੇ ਹਾਂ ਬੱਚਿਆਂ ਨੂੰ ਕਰਾ ਸਕਦੇ ਹਾਂ ਠੀਕ ਹੈ ਜੀ ਅਤੇ ਹੋਰ ਇੱਥੇ ਨਾਲ ਇੱਕ ਚਿੱਲ ਓ ਥ੍ਰਿਲ ਵਾਟਰ ਪਾਰਕ ਉੱਥੇ ਜਾ ਸਕਦੇ ਹਾਂ ਜਿੱਦਾਂ ਹੁਣ ਗਰਮੀਆਂ ਦਾ ਸੀਜ਼ਨ ਆ ਅਤੇ ਤੁਹਾਡੇ ਆ ਮਤਲਬ ਜੇ ਸਾਰਾ ਮੈਂ ਇੱਕ ਇਹਦਾ ਦੱਸਾਂ ਤਾਂ ਵੀ ਦੋ ਹਜ਼ਾਰ ਰੁਪਈਆ ਲੱਗੂਗਾ ਸਾਰ ਨੂੰ ਤੁਹਾਨੂੰ ਦੋ ਦਿਨਾਂ ਹਜ਼ਾਰ ਰੁਪਈਆ ਇੱਕ ਦਿਨ ਦਾ ਠੀਕ ਹੈ ਜੀ ਹਾਂ ਅਤੇ ਮੈਨੂੰ ਤੁਸੀਂ ਪਹੁੰਚਣ ਤੋਂ ਦੋ ਘੰਟੇ ਪਹਿਲਾਂ ਫੋਨ ਕਰ ਦੇਣਾ ਜੀ ਅਤੇ ਅਤੇ ਮੈਨੂੰ ਤੁਸੀਂ ਪਿੱਕ ਕਰ ਲੈਣਾ ਮੈਂ ਤੁਹਾਡੇ ਨਾਲ ਹੀ ਰਹੂੰਗਾ ਤੁਹਾਡੇ ਵਹੀਕਲ 'ਤੇ ਹੀ ਅਤੇ ਫਿਰ ਮੈਂ ਤੁਹਾਨੂੰ ਸਾਰੇ ਕਿਤੇ ਲੈ ਜੂ ਅਤੇ ਹਾਂਜੀ ਅਤੇ ਤੁਸੀਂ ਮੈਨੂੰ ਹਨੁੰਮਾਨ ਚੌਂਕ ਤੋਂ ਪਿੱਕ ਕਰ ਲਿਓ ਅਤੇ ਬਸ ਉੱਥੇ ਮੈਨੂੰ ਪਿੱਕ ਕਰ ਲਿਓ ਤਾਂ ਦੋ ਘੰਟੇ ਪਹਿਲਾਂ ਮੈਨੂੰ ਫੋਨ ਕਰ ਦੇਣ ਅਤੇ ਮੈਂ ਆਪਣਾ ਉਸ ਹਿਸਾਬ ਨਾਲ ਆਪਦਾ ਸ਼ਡਿਊਲ ਓ ਰੈਡੀ ਕਰ ਲੂੰਗਾ ਠੀਕ ਹੈ ਜੀ ਅਤੇ ਹਾਂਜੀ ਠੀਕ ਹੈ ਜੀ ਅਤੇ ਆਪਣਾ ਹਾਂ ਬਾਕੀ ਸਮਾਨ ਸਮੂਨ ਦਾ ਤਾਂ ਲੈ ਆਇਓ ਨਾਲ ਹੈ ਨਾ ਖਾਣਾ ਪਾਣੀ ਆਪਣਾ ਦੇਖ ਲਿਓ ਸਾਰਾ ਅਤੇ ਬਾਕੀ ਆਪਾਂ ਦੇਖ ਲਾਂਗੇ ਉੱਥੇ ਠੀਕ ਹੈ ਜੀ ਠੀਕ ਹੈ ਜੀ ਓਕੇ